ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਸ਼ਹਿਰ ਤੋਂ ਬੋਲ ਰਹੀ ਹਾਂ ਪੰਜਾਬ ਵਿੱਚ ਪ੍ਰਸਿੱਧ ਰੈਸਟੋਰੈਂਟ ਜਿਸ ਤਰ੍ਹਾਂ ਕਿ ਸਾਡੇ ਨੇੜੇ ਜਿਸ ਤਰ੍ਹਾਂ ਕਿ ਜੀ ਕੇ ਸ਼੍ਰੀ ਰਾਧੇ ਵਾਲੇ ਇਸ ਤਰ੍ਹਾਂ ਕਈ ਰੈਸਟੋਰੈਂਟ ਨੇ ਉਹਨਾਂ ਵਿੱਚ ਬਾਹਰ ਤੋਂ ਸੈਲਾਨੀਆਂ ਆਉਂਦੇ ਹਨ ਅਤੇ ਉਹ ਉੱਥੇ ਬੈਠ ਕੇ ਖਾਣਾ ਵਗੈਰਾ ਖਾਂਦੇ ਆ ਔਰ ਖਾਣ ਦਾ ਅਨੰਦ ਮਾਣਦੇ ਹੈ ਇੱਥੇ ਜਿਸ ਤਰ੍ਹਾਂ ਕਿ ਪੰਜਾਬ ਦੇ ਪ੍ਰਸਿੱਧ ਕੜੀ ਚਾਵਲ ਰਾਜਮਾਂਹ ਚਾਵਲ ਦਾਲ ਚਰਮਾਨੀ ਮੱਕੀ ਸਾ ਸਾਗ ਟੋਡਾ ਇਸ ਤਰ੍ਹਾਂ ਬਹੁਤ ਜ਼ਿਆਦਾ ਵਧੀਆ ਵਧੀਆ ਇੱਥੇ ਪਕਵਾਨ ਬਣਦੇ ਆ ਔਰ ਜਿਹੜੇ ਵੀ ਬਾਹਰੋਂ ਆਉਂਦੇ ਹੈ ਉਹ ਇੱਥੇ ਆ ਕੇ ਖਾਣ ਦਾ ਅਨੰਦ ਬਹੁਤ ਵਧੀਆ ਮਾਣਦੇ ਹੈ ਜਿਸ ਤਰ੍ਹਾਂ ਕਿ ਲੋਕ ਕਈ ਲੋਕ ਬਾਹਰ ਨਹੀਂ ਜਾ ਸਕਦੇ ਉਹ ਘਰਾਂ ਵਿੱਚ ਹੀ ਆਡਰ ਕਰ ਲੈਂਦੇ ਹੈ ਤਾਂ ਉਹਨਾਂ ਦਾ ਆਡਰ ਵੀ ਬਹੁਤ ਜਲਦੀ ਪਹੁੰਚ ਜਾਂਦਾ ਅਤੇ ਉਹ ਵੀ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਉਹਨਾਂ ਦਾ ਰੇਟ ਵੀ ਬਹੁਤ ਜ਼ਿਆਦਾ ਜੈਨੂਅਨ ਹੁੰਦਾ ਹੈ ਔਰ ਬਹੁਤ ਵਧੀਆ ਲੱਗਦਾ ਜਿਹੜੇ ਲੋਕ ਬਾਹਰੋਂ ਆਉਂਦੇ ਇੱਥੇ ਆ ਕੇ ਸਾਡੇ ਪੰਜਾਬ ਵਿੱਚ ਆ ਕੇ ਖਾ ਖਾਣ ਖਾਣੇ ਦਾ ਅਨੰਦ ਮਾਣਦੇ ਇਸ ਤਰ੍ਹਾਂ ਨਾਲ ਮਿੱਠੀਆਂ ਚੀਜ਼ਾਂ ਵੀ ਬਣਾਉਂਦੇ ਆ ਜਿਸ ਤਰ੍ਹਾਂ ਕਿ ਗੁਲਾਬ ਜਾਮੁਨ ਗਜਰੇਲਾ ਵਗੈਰਾ ਇਸ ਤਰ੍ਹਾਂ ਬਹੁਤ ਵਧੀਆ ਖਾਣੇ ਤੋਂ ਬਾਅਦ ਲੋਕ ਖਾਣਾ ਪਸੰਦ ਕਰਦੇ ਹੈ ਅਤੇ ਓਕੇ ਥੈਂਕ ਯੂ